ਪੰਜ ਨਵੰਬਰ ਦੋ ਹਜ਼ਾਰ ਦਸ ਛੇ ਅਕਤੂਬਰ ਦੋ ਹਜ਼ਾਰ ਪੰਜ ਪੰਦਰ੍ਹਾਂ ਅਗਸਤ ਉੱਨੀ ਸੌ ਸੰਨਤਾਲੀ ਛੱਬੀ ਜਨਵਰੀ ਉੱਨੀ ਸੌ ਪੰਜਾਹ ਛੱਬੀ ਦਸੰਬਰ ਦੋ ਹਜ਼ਾਰ ਤਿੰਨ